ਹਾਂਜੀ ਮੈਂ ਤੁਹਾਡੇ ਤੋਂ ਕੁਝ ਸਮਾਂ ਪਹਿਲਾਂ ਇੱਕ ਪ੍ਰੋਡਕਟ ਔਡਰ ਕੀਤਾ ਸੀ ਜੋ ਕਿ ਇੱਕ ਕੁੜਤੀ ਸੀ ਅਤੇ ਮੈਨੂੰ ਇਹ ਜਿਹੜੀ ਕੁੜਤੀ ਹੈ ਬਹੁਤ ਜ਼ਿਆਦਾ ਪਸੰਦ ਆਈ ਆ ਅਤੇ ਮੈਨੂੰ ਤੁਹਾਡੀ ਸਰਵਿਸ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਆ ਅਤੇ ਮੈਨੂੰ ਕਿਹਾ ਗਿਆ ਸੀ ਕਿ ਇਹ ਜਿਹੜਾ ਮੇਰਾ ਪ੍ਰੋਡਕਟ ਆ ਮੇਰੇ ਕੋਲ ਹਫ਼ਤੇ ਦੇ ਵਿੱਚ ਆ ਜਾਵੇਗਾ ਬਟ ਮੈਨੂੰ ਮੇਰੀ ਕੁੜਤੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਹੀ ਪ੍ਰਾਪਤ ਹੋ ਗਈ ਸੀ ਅਤੇ ਇਹ ਕੁੜਤੀ ਬਹੁਤ ਜ਼ਿਆਦਾ ਸੋਹਣੀ ਹੈ ਅਤੇ ਜਿਵੇਂ ਦੀ ਮੈਂ ਚਾਹੁੰਦੀ ਸੀ ਮਤਲਬ ਜਿਵੇਂ ਦੀ ਮੈਂ ਦੇਖੀ ਸੀ ਇਹ ਕੁੜਤੀ ਮੈਨੂੰ ਸੇਮ ਉਵੇਂ ਦੀ ਹੀ ਪ੍ਰਾਪਤ ਹੋਈ ਹੈ ਅਤੇ ਕੁੜਤੀ ਦਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਅਤੇ ਦੇਖਣ ਦੇ ਵਿੱਚ ਸਭ ਨੂੰ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਆ ਅਤੇ ਮੇਰੀਆਂ ਫ੍ਰੈਂਡਜ਼ ਨੇ ਵੀ ਇਸਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੈ ਅਤੇ ਇਸਦਾ ਸਟੱਫ਼ ਵੀ ਬਹੁਤ ਜ਼ਿਆਦਾ ਸੋਹਣਾ ਆ ਅਤੇ ਜਿਹੜਾ ਕੱਪੜਾ ਆ ਉਹ ਕੌਟਨ ਦਾ ਆ ਜੋ ਕਿ ਬਹੁਤ ਜ਼ਿਆਦਾ ਸੋਹਣਾ ਆ ਅਤੇ ਜਿਹੜਾ ਇਸਦਾ ਕਲਰ ਆ ਉਹ ਵੀ ਫੇਟ ਨਹੀਂ ਹੋਇਆ ਮੈਂ ਇਸ ਨੂੰ ਦੋ ਤੋਂ ਤਿੰਨ ਵਾਰ ਦੁਬਾਰਾ ਪਾ ਕੇ ਦੇਖ ਲਿਆ ਹੈ ਪਰ ਇਸਦਾ ਜਿਹੜਾ ਕਲਰ ਹੈ ਬਿਲਕੁਲ ਵੀ ਫੇਟ ਨਹੀਂ ਹੋਇਆ ਅਤੇ ਇਸ 'ਤੇ ਜਿਹੜਾ ਯੂਜ਼ ਕੀਤਾ ਗਿਆ ਸਟੱਫ ਆ ਉਹ ਵੀ ਬਹੁਤ ਜ਼ਿਆਦਾ ਸੋਹਣਾ ਆ ਅਤੇ ਮੈਨੂੰ ਇਹ ਤੁਹਾਡਾ ਪ੍ਰੋਡਕਟ ਬਹੁਤ ਜ਼ਿਆਦਾ ਵਧੀਆ ਲੱਗਿਆ